ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕ ਆਪਣੇ ਪਿਛੋਕੜ ਆਪਣੇ ਸੱਭਿਆਚਾਰ ਨੂੰ ਭੁੱਲੇ ਜਾ ਰਹੇ ਹਨ ਪਹਿਲਾਂ ਤਾਂ ਗੱਲ ਕਰੀਏ ਆਪਣੀ ਮਾਂ ਬੋਲੀ ਪੰਜਾਬ ਦੀ ਮਾਂ ਬੋਲੀ ਪੰਜਾਬੀ ਇਸ ਨੂੰ ਲੋਕ ਭੁੱਲਦੇ ਜਾ ਰਹੇ ਹਨ ਫਿਰ ਆਪਾਂ ਗੱਲ ਕਰੀਏ ਕਿ ਅਸੀਂ ਆਪਣੇ ਘਰ ਵਿੱਚ ਹੀ ਦੇਖ ਲਈਏ ਕਿ ਆਪਣੇ ਬੱਚਿਆਂ ਨੂੰ ਵੀ ਆਪਾਂ ਅੰਗ ਅੰਗਰੇਜ਼ੀ ਬੋਲਣ 'ਤੇ ਜ਼ਿਆਦਾ ਜ਼ੋਰ ਪਾਉਂਦੇ ਹਾਂ ਕਿ ਸਾਡਾ ਬੱਚਾ ਅੰਗਰੇਜ਼ੀ ਸਕੂਲਾਂ ਦੇ ਵਿੱਚ ਅੰਗਰੇਜ਼ੀ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹੀ ਪੜ੍ਹੇ ਅਤੇ ਉਹ ਬਿਲਕੁਲ ਵੀ ਪੰਜਾਬੀ ਜਾਂ ਹਿੰਦੀ ਭਾਸ਼ਾ ਦਾ ਇਸਤੇਮਾਲ ਨਾ ਕਰੇ ਫਿਰ ਆਪਾਂ ਲੋਕਾਂ ਦੇ ਵਿਚਕਾਰ ਇਹ ਬੜਾ ਦੇਖਦੇ ਹਾਂ ਕੀ ਲੋਕ ਅਪ ਅੰਗਰੇਜ਼ਾਂ ਦੇ ਬਣਾਏ ਹੋਏ ਅਸੂਲਾਂ ਭ ਭਾਵ ਕਿ ਜਦੋਂ ਕੋਈ ਬਡੇ ਪਾਰਟੀਆਂ ਹੁੰਦੀਆਂ ਹਨ ਤਾਂ ਅਸੀਂ ਦੇਖਦੇ ਹਾਂ ਕਿ ਲੋਕ ਅੰਗਰੇਜ਼ਾਂ ਵਾਂਗ ਹੀ ਮੋਮਬੱਤੀਆਂ ਕੇਕ ਦੇ ਉੱਤੇ ਜਗਾ ਕੇ ਅਤੇ ਉਸ ਨਾਲ ਸੈਲੀਬ੍ਰੇਸ਼ਨਾਂ ਕਰਦੇ ਹਨ ਅਤੇ ਨਸ਼ੇ ਪੱਤਿਆਂ ਵੱਲ ਵੀ ਵੱਧ ਚੁੱਕੇ ਹਨ ਜੋ ਕਿ ਪੰਜਾਬ ਦੀਆਂ ਇਹ ਸਭ ਸੰਸਕਾਰ ਇਹ ਸਭ ਰੀਤੀਆਂ ਜੋ ਪੰਜਾਬ ਦੇ ਵਿੱਚ ਪਹਿਲੇ ਨਹੀਂ ਸਨ ਅਤੇ ਹੁਣ ਅੰਗਰੇਜ਼ਾਂ ਤੋਂ ਜ਼ਿਆਦਾ ਪ੍ਰਭਾਵਿਤ ਹੋ ਕੇ ਕੁੜੀਆਂ ਜਿਹੜੀਆਂ ਨੇ ਉਹ ਜੀਨਾ ਸ਼ਾਰਟਸ ਛੋਟਸ ਸਕਰਟਾਂ ਆਦਿ ਪਾਉਂਦੀਆਂ ਹਨ ਅਤੇ ਬਹੁਤ ਸਾਰੇ ਨਸ਼ਿਆਂ ਦਾ ਵੀ ਇਸਤੇਮਾਲ ਕਰਦੀਆਂ ਹਨ